ਸਤਿ ਸ਼੍ਰੀ ਅਕਾਲ ਜੀ ਢਿੱਲੋਂ ਟੈਕਸੀ ਤੋਂ ਬੋਲਦੇ ਹੋ ਮੈਂ ਅਮਨਦੀਪ ਕੌਰ ਰੈਲ ਮਾਜਰੇ ਤੋਂ ਅਸੀਂ ਮਨਾਲੀ ਜਾਣਾ ਸੀ ਇਸ ਕਰਕੇ ਮੈਂ ਤੁਹਾਡੇ ਤੇ ਤੁਹਾਡੀ ਕੈਬ ਬੁੱਕ ਕਰਨਾ ਚਾਹੁੰਦੀ ਹਾਂ ਅਸੀਂ ਜਿਸ ਤਰ੍ਹਾਂ ਪੁੱਛਣਾ ਸੀ ਕਿ ਕਿੰਨਾ ਰੈਂਟ ਲੱਗੇਗਾ ਜਾਣ ਨੂੰ ਕਿੰਨਾ ਟਾਈਮ ਲੱਗੇਗਾ ਜਿਸ ਦਾ ਕੁਛ ਟਾਈਮ ਪਹਿਲਾਂ ਸੜਕਾਂ ਦੀ ਕੁਛ ਪ੍ਰੋਬਲਮ ਸੀ ਹੁਣ ਉਹ ਠੀਕ ਹੋ ਗਈਆਂ ਨੇ ਕਿ ਜਾਣ ਨੂੰ ਕੋਈ ਸ਼ੋਟਕੱਟ ਵਗੈਰਾ ਕੁਛ ਹੋਰ ਰਸਤਾ ਤਾਂ ਨਹੀਂ ਲੈਣਾ ਪਏਗਾ ਰਸਤੇ ਖ਼ਰਾਬ ਨੇ ਹੁਣ ਕਿ ਠੀਕ ਨੇ ਤੁਸੀਂ ਇੰਜ ਅਸੀਂ ਸਾਰਿਆਂ ਨੇ ਜਾਣਾ ਹੈ ਤੁਸੀਂ ਟਾਈਮ ਸਿਰ ਸਾਡੇ ਕੋਲ ਪਹੁੰਚ ਜਿਓ ਅਸੀਂ ਐਡਰੈੱਸ ਮੈਂ ਤੁਹਾਨੂੰ ਮੈਸੇਜ ਕਰ ਦਿੱਤਾ ਇਹ ਨੰਬਰ 'ਤੇ ਤੁਸੀਂ ਦੱਸ ਦਿਓ ਕਿੰਨੇ ਵਜੇ ਤੋਂ ਚੱਲਣਾ ਹੈ ਇਸ ਕਰਕੇ ਤੁਸੀਂ ਟਾਈਮ ਸਿਰ ਸਾਡੇ ਕੋਲ ਪਹੁੰਚ ਜਿਓ ਤੁਹਾਡਾ ਬਹੁਤ ਬਹੁਤ ਧੰਨਵਾਦ